ਪੰਜ ਅਗਸਤ ਉੱਨੀ ਸੌ ਸੰਤਾਲ਼ੀ ਅੱਠ ਜੂਨ ਉੱਨੀ ਸੌ ਨੜ੍ਹਿਨਵੇਂ ਬਾਰਾਂ ਮਾਰਚ ਪੰਦਰਾਂ ਸੌ ਛਿਆਸੀ ਚੌਦਾਂ ਅਪ੍ਰੈਲ ਦੋ ਹਜ਼ਾਰ ਇੱਕੀ ਇੱਕੀ ਸਤੰਬਰ ਉੱਨੀ ਸੌ ਅਠਾਨਵੇਂ